ਇੱਕ ਚੰਗੀ ਫੋਟੋ ਖਿੱਚਣ ਲਈ ਇੱਕ ਵਧੀਆ ਕੈਮਰਾ ਹੋਣਾ ਚਾਹੀਦਾ ਏ ਅਤੇ ਇੱਕ ਵਿਅਕਤੀ ਕਿ ਜਿਹਨੂੰ ਫੋਟੋ ਖਿੱਚਣ ਦੀ ਪੂਰੀ ਜਾਣਕਾਰੀ ਹੋਵੇ ਅਤੇ ਜਿਸ ਵੀ ਵਿਅਕਤੀ ਦੀ ਫੋਟੋ ਖਿੱਚ ਰਹੀ ਹੋਵੇ ਉਹਨੇ ਵਧੀਆ ਕੱਪੜੇ ਪਾਏ ਹੋਣ ਅਤੇ ਵਧੀਆ ਉਹਨੂੰ ਪੋਜ਼ ਆਉਂਦੇ ਹੋਣ ਅਤੇ ਉਹਦਾ ਜਿਹੜਾ ਬੈਗਰਾਊਂਡ ਹੈ ਉਹ ਬਿਲਕੁਲ ਸ ਸਾਫ ਅਤੇ ਸਪਸ਼ਟ ਹੋਵੇ ਤਾਂ ਕਿ ਜੋ ਫੋਟੋ ਹੈ ਉਹ ਵਧੀਆ ਆਵੇ